ਹੈਲੋ ਦੋਸਤ ਕੀ ਹਾਲ ਹੈ ਤੇਰਾ ਉਹ ਮੈਂ ਸੁਣਿਆ ਸੀ ਤੂੰ ਪਿਛਲੇ ਇੱਕ ਵਾਹਨ ਲੋਨ 'ਤੇ ਲਿਆ ਸੀਗਾ ਮੈਂ ਵੀ ਇੱਕ ਸੈਕਿੰਡ ਹੈਂਡ ਮੋਟਰਸਾਈਕਲ ਲੈਣ ਦਾ ਵਿਚਾਰ ਕਰ ਰਿਹਾ ਹਾਂ ਮੈਨੂੰ ਵਾਹਨ ਲੋਨ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੈਗੀ ਹੈ ਮੈਨੂੰ ਅਰਜੀ ਪ੍ਰਕਿਰਿਆ ਤੋਂ ਮੈਂ ਬਿਲਕੁਲ ਅਣਜਾਣ ਹਾਂ ਮੈਨੂੰ ਨਹੀਂ ਪਤਾ ਕਿ ਅਰਜੀ ਕਿਸ ਤਰ੍ਹਾਂ ਭਰਦੇ ਹਾਂ ਕਰਜਾ ਕਦੋ ਕਰਜੇ ਦੀ ਅਰਜੀ ਹੈ ਉਹ ਕਿਸ ਤਰ੍ਹਾਂ ਲਈ ਦੀ ਹੈ ਅਤੇ ਕਿਵੇਂ ਭਰੀ ਦੀ ਹੈ ਮੈਨੂੰ ਉਸ ਬਾਰੇ ਕੁਛ ਨਹੀਂ ਪਤਾ ਮੈਨੂੰ ਜੋ ਪਰੀਵਹਿਨ ਸੇਵਾ ਪੋਰਟਲ ਹੈਗਾ ਪੋਰਟਲ ਹੈਗਾ ਅਹੀਂ ਅਰਜੀ ਦੇਣ ਬਾਰੇ ਮੈਨੂੰ ਮਾਰਗਦਰਸ਼ਨ ਦੀ ਜ਼ਰੂਰਤ ਹੈਗੀ ਹੈ ਤਾਂ ਦੋਸਤ ਮੈਂ ਤੇਰੇ ਨਾਲ ਗੱਲ ਕਰ ਰਿਹਾ ਤੁਸੀਂ ਮੋਟਰਸਾਈਕਲ ਜੋ ਵਾਹਨ ਲਿਆ ਸੀਗਾ ਤੁਸੀਂ ਉਸ ਲਈ ਲੋਨ ਅਰਜੀ ਅਪਲਾਈ ਕੀਤੀ ਸੀਗੀ ਅਰਜੀ ਦਿੱਤੀ ਸੀਗੀ ਪਰੀਵਹਿਨ ਸੇਵਾ ਰਾਹੀਂ ਕਰਜਾ ਅਰਜੀ ਜੋ ਹੈ ਉਹ ਮੈਂ ਕਿਸ ਤਰ੍ਹਾਂ ਭਰਾ ਉਸ 'ਤੇ ਕਿਸ ਤਰ੍ਹਾਂ ਚੱਲਾਂ ਕੀ ਕੀ ਸਟੈਪ ਨੇ ਉਹਦੇ ਉਸ ਬਾਰੇ ਮੈਨੂੰ ਭਰਾ ਮੇਰਿਆ ਦੱਸ ਇਸ ਬਾਰੇ ਮੈਨੂੰ ਸਲਾਹ ਦਿਓ ਅਤੇ ਮੈਨੂੰ ਮਾਰਗਦਰਸ਼ਨ ਦੀ ਬਹੁਤ ਹੀ ਲੋੜ ਹੈ ਮੈਨੂੰ ਇਸ ਬਾਰੇ ਕੁਛ ਨਹੀਂ ਪਤਾ ਤੁਸੀਂ ਮੈਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਸਾਰਾ ਦੱਸ ਦਿਉ ਵੀ ਕਿਸ ਤਰ੍ਹਾਂ ਇਹ ਪ੍ਰਕਿਰਿਆ ਚਲਦੀ ਹੈ ਅਤੇ ਕਿਸ ਤਰ੍ਹਾਂ ਮੈਂ ਇਸ ਵਿੱਚ ਅੱਗੇ ਵਧਣਾ ਹੈ ਅਤੇ ਕਰਜਾ ਕਿਵੇਂ ਕਿਸ਼ਤਾਂ ਰਾਹੀਂ ਦੇ ਸਕਦੇ ਹਾਂ ਜਾਂ ਇੱਕ ਵਾਰੀ ਕ ਕਿਵੇਂ ਹੁੰਦਾ ਇਹਨੂੰ ਸਾਰਾ ਬਸ ਸਾਰੀ ਸਕੀਮ ਬਾਰੇ ਦੱਸ ਦਿਉ ਜੋ ਪੋਰਟਲ ਹੈਗਾ ਪੋਰਟਲ ਕਿਸ ਤਰ੍ਹਾਂ ਭਰੀਦਾ ਹੈ ਉਸ ਦੀ ਵੀ ਮੈਨੂੰ ਸਾਰੀ ਜਾਣਕਾਰੀ ਦਿਓ ਮੈਨੂੰ ਬਹੁਤ ਜ਼ਿਆਦਾ ਲੋੜ ਹੈ ਮੈਨੂੰ ਜ਼ਿਆਦਾ ਕੰਮ ਨਹੀਂ ਆਉਂਦਾ ਇਸ ਦਾ ਪਤਾ ਨੀ ਹੈ ਮੈਨੂੰ ਇਸ ਬਾਰੇ ਕੁਛ ਵੀ ਮੈਂ ਸੈਕਿੰਡ ਹੈਂਡ ਮੋਟਰਸਾਈਕਲ ਲੈਣਾ ਹੈ ਮੈਂ ਗਰੀਬ ਬੰਦਾ ਤੈਨੂੰ ਪਤਾ ਮੇਰੀ ਹੈਲਪ ਮੇਰੀ ਮਦਦ ਕਰ ਲਾਭ ਮਿਲਿਆ ਤਾਂ ਜੋ ਮੈਂ ਇਹਨੂੰ ਭਰ ਸਕਾਂ ਜਲਦੀ ਤੋਂ ਜਲਦੀ ਅਤੇ ਆਪਣਾ ਸੈਕਿੰਡ ਹੈਂਡ ਮੋਟਰਸਾਈਕਲ ਲੈ ਕੇ ਆਪਣੇ ਕੰਮ ਕਾਰ ਪੂਰੇ ਕਰ ਸਕਾਂ ਆਪਣੇ ਕੰਮ 'ਤੇ ਟਾਈਮ ਸਿਰ ਪਹੁੰਚ ਸਕ